ਹਾਂ ਇਨ੍ਹਾਂ ਖੇਤਰਾਂ ਦੇ ਵਿਦਿਆਰਥੀ ਸਕੂਲਾਂ ਵਿੱਚ ਦੌੜਨ ਵਿੱਚ ਰੁੱਝੇ ਹੋਏ ਹਨ ਕਿਉਂਕਿ ਉਹ ਦੌੜ ਦੌੜਦੇ ਹਨ ਅਤੇ ਇਸ ਨਾਲ ਉਹ ਅੰਤਰਰਾਸ਼ਟਰੀ ਖੇਡਾਂ ਨਾਲ ਜੁੜ ਸਕਦੇ ਹਨ ਜੋ ਕਿ ਉਨ੍ਹਾਂ ਦੀ ਇਕਨਾਮਿਕ ਗ੍ਰੋਥ ਲਈ ਵੀ ਬਹੁਤ ਜ਼ਰੂਰੀ ਹੈ ਦੌੜਨਾ ਛੋਟੇ ਬੱਚਿਆਂ ਲਈ ਬਹੁਤ ਸਿਹਤਮੰਦ ਹੈ ਇਸ ਨਾਲ ਉਨ੍ਹਾਂ ਨੂੰ ਤੰਦਰੁਸਤ ਰਹਿਣ ਵਿੱਚ ਬਹੁਤ ਮਦਦ ਮਿਲਦੀ ਹੈ ਇਸ ਨਾਲ ਉਹ ਫਿੱਟ ਰਹਿੰਦੇ ਹਨ ਅਤੇ ਉਹ ਮੋਟਾਪਾ ਮੁਕਤ ਰਹਿੰਦੇ ਹਨ